ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਚੰਗੇ ਖਾਤੇ ਹਨ ਜਿਨ੍ਹਾਂ ਦੀ ਮੈਂ ਪਾਲਣਾ ਕਰਦਾ ਹਾਂ ਜਿਨ੍ਹਾਂ ਤੋਂ ਮੈਂ ਚੰਗੀ ਸੇਧ ਆਪਣੇ ਜੀਵਨ ਵਿੱਚ ਲੈਂਦਾ ਹਾਂ ਜਿਵੇਂ ਗੁਰਬਾਣੀ ਵਿਚਾਰ ਸਿੱਖ ਮੀਡੀਆ ਗੁਰਸਿੱਖੀ ਜੀਵਨ ਇਸ ਤਰੀਕੇ ਦੇ ਬਹੁਤ ਹੀ ਚੰਗੇ ਖਾਤੇ ਹਨ ਜਿਹੜੇ ਰੋਜ਼ਾਨਾ ਦੀ ਰੋਜ਼ਾਨਾ ਗੁਰਬਾਣੀ ਗੁਰੂ ਰਾਹੀਂ ਸਾਡੇ ਮਨ ਨੂੰ ਚੰਗੇ ਖਿਆਲ ਚੰਗੇ ਵਿਚਾਰ ਚੰਗੀਆਂ ਸਾਧਨਾ ਸਾਨੂੰ ਸੇਧ ਸਾਨੂੰ ਦਿੰਦੇ ਨੇ ਹੋਰ ਵੀ ਬਹੁਤ ਸਾਰੇ ਸੋਸ਼ਲ ਖਾਤੇ ਹਨ ਜਿਨ੍ਹਾਂ ਤੋਂ ਮੈਂ ਆਪਣੇ ਜੀਵਨ ਵਿੱਚ ਕਾਫੀ ਸੇਧ ਲੈਂਦਾ ਹਾਂ ਕੁਛ ਖਾਤੇ ਇਸ ਤਰ੍ਹਾਂ ਵੀ ਹਨ ਜਿਨ੍ਹਾਂ ਤੋਂ ਮੈਂ ਚੰਗੇ ਸੰਗੀਤ ਨੂੰ ਸੁਣਨਾ ਪਸੰਦ ਕਰਦਾ ਹਾਂ ਅਤੇ ਚੰਗੀ ਵੀਡੀਓ ਨੂੰ ਦੇਖ ਕੇ ਆਪਣੇ ਮਨ ਦਾ ਤਣਾਅ ਦੂਰ ਕਰਦਾ ਹਾਂ